ਸਾਡੇ ਖੇਤਰ ਵਿੱਚ ਪਾਣੀ ਦੇ ਸ੍ਰੋਤ ਨਦੀਆਂ ਨਾਲੇ ਹਨ ਜੋ ਕਿ ਇਹਨਾਂ ਦੁਆਰਾ ਖੇਤੀ ਦੀ ਸਿੰਜਾਈ ਕੀਤੀ ਜਾਂਦੀ ਹੈ ਜਿਵੇਂ ਕਿ ਕਣਕ ਝੋਨਾ ਅਤੇ ਕਪਾਹ ਆਦਿ ਇਹ ਇਹਨਾਂ ਦੀ ਖ਼ਰੀਦੋ ਫ਼ਰੋਕਤ ਐੱਫ ਸੀ ਆਈ ਵਰਗੀਆਂ ਏਜੰਸੀਆਂ ਕਰਦੀਆਂ ਹਨ ਜੋ ਕਿ ਉਨ੍ਹਾਂ ਦੇ ਪੇਮੈਂਟ ਉਹਨਾਂ ਦੇ ਖਾਤੇ ਕਿਸਾਨਾਂ ਦੇ ਖਾਤੇ ਵਿੱਚ ਡਾਇਰੈਕਟ ਪਾਈ ਜਾਂਦੀ ਹੈ ਜਿਸ ਦੁਆਰਾ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਅਤੇ ਉਹ ਵਪਾਰਕ ਕੰਮਾਂ ਲਈ ਇਹ ਪੈਸਾ ਵਰਤਦੇ ਹਨ ਜਿਵੇਂ ਕਿ ਕੱਪੜਾ ਆਦਿ ਖਰੀਦਣਾ ਔਰ ਖੇਤੀ ਦੇ ਬੀਜ ਖਰੀਦਣਾ ਅਤੇ ਖੇਤੀ ਦੇ ਸੰਦ ਆਦਿ ਖਰੀਦਣਾ ਉਹ ਉਹ ਖਰੀਦ ਕੇ ਆਪਣੇ ਬੜਾ ਉਹਨਾਂ ਨੂੰ ਲਾਹੇਵੰਦ ਸਾਬਿਤ ਹੁੰਦਾ ਹੈ